ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਮਾਨਵ ਪਠਾਣੀਆ ਹੈ ਪੰਜ ਇੰਟਰਨੈਸ਼ਨਲ ਸਿਟੀਜ ਕੁਝ ਇਸ ਪ੍ਰਕਾਰ ਹਨ ਪਹਿਲੀ ਇੰਟਰਨੈਸ਼ਨ ਸਿਟੀਜ ਦਾ ਨਾਮ ਨਿਊਯੋਕ ਜੋ ਕਿ ਵਰਲਡ ਫੇਮਸ ਹੈ ਦੂਜੀ ਦੀ ਗੱਲ ਕਰਾਂ ਤਾਂ ਲੰਡਨ ਤੀਜੀ ਇੰਟਰਨੈਸ਼ਨਲ ਸਿਟੀ ਪੈਰਿਸ ਚੌਥੀ ਟੋਕਿਓ ਅਤੇ ਜੇ ਮੈਂ ਆਖਰੀ ਸਿਟੀ ਦੀ ਗੱਲ ਕਰਾਂ ਤਾਂ ਉਹ ਹੈ ਸਿਡਨੀ ਧੰਨਵਾਦ